ਪਿੰਡਾਂ ਦਾ ਮਾਹੌਲ ਇੱਕ ਐਸਾ ਮਾਹੌਲ ਸੀ ਜੋ ਕਿ ਪੁਰਾਣੇ ਸੱਭਿਆਚਾਰ ਅਤੇ ਰੀਤੀ ਰਿਵਾਜ਼ਾਂ ਦੇ ਨਾਲ ਹੀ ਸੱਜਦਾ ਹੈ ਪਿੰਡਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਾ ਪਹਿਲਾਂ ਬਹੁਤ ਹੀ ਵਧੀਆ ਹੁੰਦਾ ਸੀ ਅਤੇ ਮਨੋਰੰਜਨ ਨੂੰ ਲੈ ਕੇ ਕਾਫੀ ਜ਼ਿਆਦਾ ਲੋਕ ਗੀਤ ਲੋਕ ਬੋਲੀਆਂ ਕਾਫੀ ਮਿਲ ਵਰਤ ਕੇ ਫਸਲਾਂ ਨੂੰ ਵੱਢਦੇ ਸੀ ਮਿਲ ਵਰਤ ਕੇ ਸਾਰੇ ਕੰਮ ਕਰਦੇ ਸੀ ਉਨ੍ਹਾਂ ਹੀ ਚੀਜ਼ਾਂ ਨੂੰ ਦੇਖਦੇ ਹੋਏ ਵਿਆਹਾਂ ਸ਼ਾਦੀਆਂ ਦਾ ਮਾਹੌਲ ਵੀ ਪਹਿਲਾਂ ਦੀ ਤਰ੍ਹਾਂ ਜਸ਼ਨਾਂ ਕਲੱਬਾਂ ਅਤੇ ਫੰਕਸ਼ਨਾਂ ਵਿੱਚ ਮਨਾਇਆ ਜਾਂਦਾ ਉਸੇ ਤਰ੍ਹਾਂ ਹੀ ਸ਼ਰਾਬਾਂ ਪੀਤੀਆਂ ਜਾਂਦੀਆਂ ਸੀ ਅਤੇ ਇਹ ਚੀਜ਼ ਦੇਖਦੇ ਹੋਏ ਇਹ ਸਹੀ ਵੀ ਨਹੀਂ ਕਿ ਹੋਰ ਬੰਦਿਆਂ ਨੂੰ ਪਰੇਸ਼ਾਨ ਕਰਨਾ ਜਿਸ ਦੇ ਨਾਲ ਉੱਚੀ ਆਵਾਜ਼ ਵਿੱਚ ਗੀਤ ਲਗਾਉਣੇ ਅਤੇ ਆਪਣੇ ਸ਼ਰਾਬ ਪੀ ਕੇ ਆਪਸ ਵਿੱਚ ਲੜਾਈ ਕਰਨੀ ਫਿਰ ਮੇਰੇ ਸਮਝ ਮੁਤਾਬਕ ਤਾਂ ਇਹ ਬਹੁਤ ਹੀ ਗਲਤ ਹੈ ਅਤੇ